ਸਾਡੇ ਘਰ ਵਿੱਚ ਬਹੁਤ ਸਾਰੇ ਬੂਟੇ ਹਨ ਅਸੀਂ ਕਾਫੀ ਬੂਟੇ ਲਗਾਏ ਹੋਏ ਹਨ ਜਿਵੇਂ ਫੁੱਲਾਂ ਵਿੱਚੋਂ ਬੀ ਉਗਾਉਂਦੇ ਹਾਂ ਅਤੇ ਉਹਨਾਂ ਤੋਂ ਹੀ ਕਾਫੀ ਬੂਟੇ ਪੈਦਾ ਹੁੰਦੇ ਹਨ ਜਿਵੇਂ ਮਿਰਚਾਂ ਦੇ ਬੀ ਅਸੀਂ ਉਗਾਉਂਦੇ ਹਾਂ ਅਤੇ ਉਹਨਾਂ ਤੋਂ ਕਾਫੀ ਬੂਟੇ ਪੈਦਾ ਹੁੰਦੇ ਹਨ ਜਿਵੇਂ ਗੁਲਾਬ ਦੇ ਫੁੱਲ ਦੀ ਕਲਮ ਕੱਟ ਕੇ ਲਾਉਨੇ ਹੋ ਤਾਂ ਉੱਥੋਂ ਵੀ ਬੂਟਾ ਪੈਦਾ ਹੁੰਦਾ ਹੈ ਕਈ ਇਹੋ ਜਿਹੇ ਬੂਟੇ ਹੁੰਦੇ ਹਨ ਜਿਹੜੇ ਜੜ੍ਹਾਂ ਵਾਲੇ ਬੂਟੇ ਲਾ ਲਈਏ ਤਾਂ ਉੱਥੋਂ ਕਾਫੀ ਵੈ ਫਾਇਦੇ ਹੁੰਦੇ ਹਨ ਜਿਵੇਂ ਹੀ ਉਹ ਕਾਫੀ ਜਵਾਨ ਹੋ ਜਾਂਦੇ ਹਨ ਅਤੇ ਉਹਨਾਂ ਦੀ ਹਰਿਆਲੀ ਹੋ ਜਾਂਦੀ ਆ ਅਤੇ ਉਹ ਸਾਡਾ ਵਾਤਾਵਰਨ ਵਧੀਆ ਹੁੰਦਾ ਹੈ ਇਸ ਲਈ ਇਹ ਉਹ ਪ੍ਰਦੂਸ਼ਣ ਤੋਂ ਸਾਨੂੰ ਕਾਫੀ ਦੂਰ ਰੱਖਦੇ ਹਨ ਇਸ ਲਈ ਕਈ ਫ਼ਲ ਫਰੂਟ ਵਾਲੇ ਸਾਡੇ ਬੂਟੇ ਹਨ ਜਿਵੇਂ ਫ਼ਲ ਫਰੂਟ ਵਾਲੇ ਬੂਟਿਆਂ ਨੂੰ ਅਸੀਂ ਉਗਾਉਂਦੇ ਹਾਂ ਤਾਂ ਉਹ ਸਾਨੂੰ ਕਾਫੀ ਬੈਨੀਫਿਟ ਦਿੰਦੇ ਹਨ ਜਿਵੇਂ ਉਹਨਾਂ ਨੂੰ ਫ਼ਲਾਂ ਨੂੰ ਤੋੜ ਕੇ ਅਸੀਂ ਮੰਡੀ ਵਿੱਚ ਲੈ ਕੇ ਜਾਦੇ ਹਾਂ ਮੰਡੀ ਤੋਂ ਬਾਅਦ ਦੁਕਾਨਦਾਰ ਖਰੀਦਦੇ ਹਨ ਇਸ ਕਰਕੇ ਦੁਕਾਨਦਾਰ ਖਰੀਦਦੇ ਹਨ ਅਤੇ ਉਹਨਾਂ ਤੋਂ ਕਾਫੀ ਸਾਨੂੰ ਨੂੰ ਬੈਨੀਫਿਟ ਹੁੰਦਾ ਆ ਅਤੇ ਇਸ ਲਈ ਇਹ ਸਾਨੂੰ ਬਹੁਤ ਵਧੀਆ ਵੀ ਲੱਗਦਾ ਆ ਕਿ ਅਸੀਂ ਆਪਣੀ ਚੀਜ਼ ਉਗਾਈ ਹੋਏ ਅਤੇ ਸਾਨੂੰ ਬੈਨੀਫਿਟ ਮਿਲਦਾ ਆ ਅਤੇ ਇਸ ਲਈ ਇਹ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਪ੍ਰਦੂਸ਼ਣ ਵੀ ਬਿਲਕੁਲ ਸਾਫ਼ ਅਤੇ ਸਾਫ਼ ਸੁਥਰਾ ਰਹਿੰਦਾ ਹੈ